ਪੰਜਾਬ ਵਿੱਚ ਪ੍ਰਮੁੱਖ ਧਾਰਮਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਲਨ ਕੀਤਾ ਜਾਂਦਾ ਹੈ ਕਾਫੀ ਧਰਮਾਂ ਦੇ ਲੋਕ ਹਨ ਜਿਵੇਂ ਕਿ ਸਭ ਆਪਣੇ ਧਰਮਾਂ ਦੇ ਧਰਮਾਂ ਦਾ ਪਾਲਣ ਕਰਦੇ ਹਨ ਜਿਵੇਂ ਵੇਦ ਕੁਰਾਨ ਬਾਈਬਲ